ਸਾਡੀ ਰਸੋਈ ਵਿੱਚ ਬਿਜਲੀ ਦੇ ਕਈ ਉਤਪਾਦ ਉਪਕਰਨ ਹਨ ਜਿਨ੍ਹਾਂ ਦੇ ਸਾਰੇ ਖਾਣਾ ਬਣਾਉਣ ਦੇ ਤਰੀਕੇ ਨੂੰ ਬਿਲਕੁਲ ਬਦਲ ਦਿੱਤਾ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਕੋਲ ਇਹ ਮਿਕਸਚਰ ਗਰੈਂਡਰ ਹੈ ਜਿਸ ਨਾਲ ਮੈਂ ਮਸਾਲੇ ਪੀਸਦੀ ਹਾਂ ਚਟਨੀ ਬਣਾਉਂਦੀ ਹਾਂ ਅਤੇ ਹੋਰ ਵੀ ਬਹੁਤ ਸਾਰੇ ਕੰਮ ਕਰਦੀ ਹਾਂ ਫਿਰ ਇੱਕ ਸਿਲੰਡਰ ਵੀ ਹੈ ਜਿਸ ਨਾਲ ਮੈਂ ਆਟਾ ਗੁੰਦਾ ਗੁੰਨਦੀ ਹਾਂ ਅਤੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੀ ਹਾਂ ਇਸ ਤੋਂ ਇਲਾਵਾ ਸਾਡੇ ਕੋਲ ਇੱਕ ਗੈਸ ਸਿਲੰਡਰ ਵੀ ਸੀ ਜਿਸ 'ਤੇ ਅਸੀਂ ਰੋਜ਼ਾਨਾ ਖਾਣਾ ਬਣਾਉਂਦੇ ਸੀ ਹੁਣ ਤਾਂ ਇਲੈਕਟਰੋਨਿਕ ਗੈਸ ਸਟੋਪ ਵੀ ਆ ਗਏ ਹਨ ਪਰ ਅਸੀਂ ਅਜੇ ਵੀ ਗੈਸ ਸਿਲੰਡਰ ਹੀ ਵਰਤਦੇ ਹਾਂ ਫਿਰ ਸਾ ਸਾਡੇ ਕੋਲ ਇੱਕ ਓਵਨ ਵੀ ਹੈ ਜਿਸ ਨਾਲ ਅਸੀਂ ਕੇਕ ਬਿਸਕੁਟ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਾਉਂਦੇ ਹਾਂ ਓਵਨ ਨਾਲ ਖਾਣਾ ਬਣਾਉਣਾ ਬਹੁਤ ਸੌਖਾ ਹੋ ਜਾਂਦਾ ਹੈ ਅਤੇ ਖਾਣਾ ਵੀ ਬਹੁਤ ਸੁਆਦੀ ਬਣਦਾ ਹੈ ਜੇ ਗੱਲ ਕਰੀਏ ਪੁਰਾਣੇ ਦਿਨਾਂ ਦੀ ਜਦੋਂ ਇਹ ਸਾਰੇ ਉਪਕਰਨ ਉਪਲੱਬਧ ਨਹੀਂ ਸਨ ਤਾਂ ਖਾਣਾ ਬਣਾਉਣਾ ਬਹੁਤ ਮੁਸ਼ਕਿਲ ਸੀ ਪੁਰਾਣੇ ਸਮੇਂ ਵਿੱਚ ਮਸਾਲੇ ਹੱਥ ਨਾਲ ਪੀਸਣੇ ਪੈਂਦੇ ਸਨ ਜਿਸ ਵਿੱਚ ਬਹੁਤ ਸਮਾਂ ਲੱਗਦਾ ਸੀ ਆਟਾ ਵੀ ਹੱਥ ਨਾਲ ਗੁੰਨਣਾ ਪੈਂਦਾ ਸੀ ਜਿਸ ਨਾ ਜਿਸ ਵਿੱਚ ਬਹੁਤ ਮਿਹਨਤ ਲੱਗਦੀ ਸੀ ਉਹ ਸਮੇਂ ਉਸ ਸਮੇਂ ਗੈਸ ਸਿਲੰਡਰ ਵੀ ਹੁੰਦੇ ਸਨ ਇਸ ਲਈ ਲੋਕ ਲੱਕੜਾਂ ਜਾਂ ਕੋਲਿਆਂ 'ਤੇ ਖਾਣਾ ਬਣਾਉਂਦੇ ਸਨ ਇਸ ਵਿੱਚ ਬਹੁਤ ਧੂੰਆ ਹੁੰਦਾ ਸੀ ਅਤੇ ਖਾਣਾ ਬਣਾਉਣ ਵਿੱਚ ਵੀ ਬਹੁਤ ਸਮਾਂ ਲੱਗਦਾ ਸੀ ਓਵਨ ਵੀ ਨਹੀਂ ਹੁੰਦੇ ਸਨ ਇਸ ਲਈ ਲੋਕ ਕੇਕ ਅਤੇ ਬਿਸਕੁਟ ਵਰਗੀਆਂ ਚੀਜ਼ਾਂ ਨਹੀਂ ਬਣਾ ਸਕਦੇ ਸਨ ਮੈਨੂੰ ਯਾਦ ਹੈ ਕਿ ਮੇਰੀ ਦਾਦੀ ਜੀ ਦੱਸਦੇ ਹੁੰਦੇ ਸੀ ਕਿ ਉਹ ਚੱਕੀ ਦੇ ਮ ਮਸਾਲੇ ਪੀਸਦੇ ਹੁੰਦੇ ਸੀ ਅਤੇ ਲੱਕੜਾਂ 'ਤੇ ਖਾਣਾ ਬਣਾਉਂਦੇ ਸੀ ਉਹ ਕਹਿੰਦੇ ਸੀ ਕਿ ਖਾਣਾ ਬਣਾਉਣਾ ਬਹੁਤ ਮਿਹਨਤ ਵਾਲਾ ਕੰਮ ਸੀ ਪਰ ਖਾਣਾ ਬਹੁਤ ਸੁਆਦ ਬਣਦਾ ਸੀ ਅੱਜ ਕੱਲ੍ਹ ਬਿਜਲੀ ਦੇ ਉਪਕਰਨਾਂ ਨੇ ਸਾਡੇ ਖਾਣਾ ਬਣਾਉਣ ਦੇ ਤਰੀਕੇ ਨੂੰ ਬਹੁਤ ਹੀ ਸੌਖਾ ਬਣਾ ਦਿੱਤਾ ਹੈ ਹੁਣ ਅਸੀਂ ਘੱਟ ਸਮੇਂ ਵਿੱਚ ਅਤੇ ਘੱਟ ਮਿਹਨਤ ਨਾਲ ਬਹੁਤ ਸੁਆਦੀ ਖਾਣਾ ਬਣਾ ਸਕਦੇ ਹਾਂ ਪਰ ਮੈਨੂੰ ਲੱਗਦਾ ਹੈ ਕਿ ਪੁਰਾਣੇ ਸਮੇਂ ਵਿੱਚ ਖਾਣਾ ਬਣਾਉਣ ਵਿੱਚ ਜੋ ਮਿਹਨਤ ਅਤੇ ਪਿਆਰ ਹੁੰਦਾ ਸੀ ਉਹ ਅੱਜ ਕੱਲ੍ਹ ਘੱਟ ਗਿਆ ਹੈ ਹੁਣ ਸਭ ਕੁਝ ਜਲਦੀ ਹੋ ਜਾਂਦਾ ਹੈ ਅਤੇ ਲੋਕਾਂ ਕੋਲ ਖਾਣਾ ਬਣਾਉਣ ਲਈ ਜ਼ਿਆਦਾ ਸਮਾਂ ਨਹੀਂ ਹੁੰਦਾ ਖੈਰ ਸਮਾਂ ਬਦਲ ਗਿਆ ਅਤੇ ਸਾਨੂੰ ਆਪਣੇ ਤਰੀਕਿਆਂ ਨਾਲ ਅਪਣਾਉਣਾ ਪੈਂਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਪੁਰਾਣੇ ਸਮੇਂ ਦੇ ਕੁਝ ਚੰਗੇ ਗੁਣਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜਿਵੇਂ ਕਿ ਮਿਹਨਤ ਪਿਆਰ ਅਤੇ ਧੀਰਜ